ਜਿਵੇਂ ਕਿ ਆਪਾਂ ਥੋੜ੍ਹੇ ਸਮੇਂ ਪਹਿਲਾਂ ਦੀਆਂ ਗੱਲਾਂ ਕਰੀਏ ਅੱਜ ਤੋਂ ਦਸ ਵੀਹ ਸਾਲ ਤਾਂ ਉਦੋਂ ਸਿਰਫ਼ ਪੰਜਾਬੀ ਅਖ਼ਬਾਰ ਹੀ ਆਉਂਦੇ ਸੀ ਪੰਜਾਬ ਦੇ ਵਿੱਚ ਅਖ਼ਬਾਰ ਵੀ ਅਜੀਤ ਜਗਬਾਣੀ ਇਸ ਤਰ੍ਹਾਂ ਦੇ ਅਲੱਗ ਅਲੱਗ ਟਾਈਪ ਦੇ ਆਉਂਦੇ ਸੀਗੇ ਪੰਜਾਬ ਦੇ ਵਿੱਚ ਅਤੇ ਉਹ ਅਖ਼ਬਾਰਾਂ ਦੇ ਰਾਹੀ ਹੀ ਨਿਊਜ ਪਹੁੰਚਦੀ ਸੀ ਅਤੇ ਉਹ ਇੱਕ ਦਿਨ ਲੱਗ ਜਾਂਦਾ ਸੀ ਉਹਨਾਂ ਨੂੰ ਜਿਵੇਂ ਸ਼ਾਮ ਦੀ ਖਖ਼ਰ ਲੱਗੀ ਹੈ ਤਾਂ ਸਵੇਰੇ ਉਹ ਪਹੁੰਚਦੀ ਸੀਗੀ ਲੋਕਾਂ ਦੇ ਕੋਲ ਪਰ ਹੁਣ ਕੀ ਆ ਹੁਣ ਟੈਕਨੋਲਜੀ ਦਾ ਯੁੱਗ ਹੈ ਉਹਦੇ ਕਰਕੇ ਬਹੁਤ ਸਾਰੇ ਨਿਊਜ਼ ਚੈਨਲ ਬਣੇ ਨੇ ਜਿਵੇਂ ਪੰਜਾਬ ਦੇ ਵਿੱਚ ਵਾ ਅ ਗੱਲ ਕਰੀਏ ਆਪਾਂ ਪੀ ਟੀ ਸੀ ਨਿਊਜ਼ ਜੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਏਟੀਨ ਪੰਜਾਬ ਹਰਿਆਣਾ ਅਤੇ ਚੜ੍ਹਦੀ ਕਲਾ ਪੀ ਟੀ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਚੈਨਲ ਬਣੇ ਨੇ ਜਿਹੜੇ ਆਪਾਂ ਨੂੰ ਲਾਈਵ ਵੀ ਦਿਖਾ ਰਹੇ ਨੇ ਤੁਰੰਤ ਜਿਹੜੀ ਵੀ ਘਟਨਾ ਜਿੱਥੇ ਹੁੰਦੀ ਆ ਉਹ ਤੁਰੰਤ ਹੀ ਲੋਕਾਂ ਸਾਹਮਣੇ ਪੇਸ਼ ਕਰ ਦਿੰਦੇ ਨੇ ਇਹ ਚੈਨਲਾਂ ਦੀ ਇੱਕ ਬਹੁਤ ਵਧੀਆ ਗੱਲ ਹੈ ਕੋਈ ਵੀ ਆਪਾਂ ਜਿਵੇਂ ਕਹਿ ਦੇਈਏ ਰਾਜਨੀਤਿਕ ਪਾਰਟੀਆਂ ਨੇ ਉਹ ਕੋਈ ਲੋਕਾਂ 'ਤੇ ਅੱਤਿਆਚਾਰ ਕਰਦੇ ਨੇ ਜਾਂ ਦਬਾਅ ਪਾਉਂਦੇ ਨੇ ਉਹ ਵੀ ਨਾਲ ਦੀ ਨਾਲ ਦਿਖਾਏ ਜਾਂਦੇ ਨੇ ਤਾਂ ਨਿਊਜ਼ ਚੈਨਲਾਂ ਦੀ ਅੱਜ ਕੱਲ੍ਹ ਦੇ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਇਹ ਵੀ ਲੋਕਤੰਤਰ ਦਾ ਇੱਕ ਬਹੁਤ ਵੱਡਾ ਅੰਗ ਹੈ ਜਿਹਦੇ ਨਾਲ ਲੋਕਤੰਤਰ ਬਚਿਆ ਹੋਇਆ ਜਿੱਥੇ ਵੀ ਲੋਕਾਂ ਨਾਲ ਧੱਕਾ ਹੁੰਦਾ ਸਭ ਕੁਛ ਇਹਦੇ ਵਿੱਚ ਦਿਖਾਇਆ ਜਾਂਦਾ ਤਾਂ ਇੱਕ ਬਹੁਤ ਵਧੀਆ ਨਿਊਜ਼ ਚੈਨਲ ਨੇ ਸਾਰੇ